ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨੌਜਵਾਨ ਪੀੜ੍ਹੀ ਦਾ ਧਿਆਨ ਯੂਟਿਊਬ ਹੋ ਗਿਆ ਫੇਸਬੁੱਕ ਹੋ ਗਿਆ ਇੰਸਟਾਗ੍ਰਾਮ ਹੋ ਗਿਆ ਇਹਨਾਂ 'ਤੇ ਰੀਲਸ ਬਣਾਉਣਾ ਆਪਣੀ ਐਕਟਿੰਗ ਕਰਨਾ ਬਿਲੋਗਸ ਬਣਾਉਣਾ ਜਿਹੜੇ ਉਹ ਇਸ ਪਾਸੇ ਵੱਲ ਜ਼ਿਆਦਾ ਜਾ ਰਹੇ ਆ ਇਹਦੇ ਤੋਂ ਉਹਨਾਂ ਨੂੰ ਕਾਫੀ ਜਿਹੜਾ ਫਾਇਦਾ ਹੋ ਰਿਹਾ ਇੱਕ ਤਾਂ ਉਹਨਾਂ ਦਾ ਨਾਮ ਦੂਸਰਾ ਉਹਨਾਂ ਨੂੰ ਪੈਸਾ ਮਿਲ ਰਿਹਾ ਠੀਕ ਹੈ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਸੌਖੀ ਲੰਘ ਰਹੀ ਹੈ ਅਤੇ ਬਾਕੀ ਨੌਜਵਾਨ ਪੀੜ੍ਹੀ ਦਾ ਜਿਹੜਾ ਧਿਆਨ ਹੈ ਉਹ ਆਪਣੇ ਦੇਸ਼ ਦੇ ਜਿਹੜੇ ਕਲਚਰ ਨੂੰ ਮੋਡੀਫਾਈ ਕਰਕੇ ਲਿਆਉਣਾ ਉਹ ਆਪਣੇ ਕਲਚਰ ਵੱਲ ਕਾਫੀ ਉਹਨਾਂ ਦਾ ਜਿਹੜਾ ਉਹਨਾਂ ਦਾ ਇੰਟਰਸਟ ਵੱਧ ਰਿਹਾ ਉਹ ਆਪਣੇ ਕਲਚਰ ਨੂੰ ਮੋਡੀਫਾਈ ਕਰ ਰਹੇ ਆ ਇਹ ਮਤਲਬ ਕਿ ਜਿਹੜੀ ਨੌਜਵਾਨ ਪੀੜ੍ਹੀ ਸਕੂਨ ਅਤੇ ਐਸ਼ ਵੀ ਚਾਹੁੰਦੀ ਹੈ ਕਿਉਂਕਿ ਅੱਜ ਕੱਲ੍ਹ ਦੀ ਲਾਈਫ ਅੱਜ ਕੱਲ੍ਹ ਦੀ ਜਿਹੜੀ ਲਾਈਫ ਹੈ ਇਹਦੇ ਵਿੱਚ ਕੰਮ ਜਿਹੜੇ ਬਹੁਤੇ ਔਖੇ ਨਹੀਂ ਰਹੇ ਪੁਰਾਣੇ ਟਾਈਮ ਦੇ ਮੁਕਾਬਲੇ ਤਾਂ ਬੱਚੇ ਚਾਹੁੰਦੇ ਆ ਕਿ ਜਿਹੜਾ ਸਾਡਾ ਸਾਨੂੰ ਸਾਡਾ ਕੰਮ ਵੀ ਸੌਖਾ ਹੋਵੇ ਅਤੇ ਸਾਨੂੰ ਜਿਹੜਾ ਪੈਸਾ ਵੀ ਜਿਹੜਾ ਮਿਲ ਬਣੇ ਉਸ ਕੰਮ ਤੋਂ ਅੱਜ ਕੱਲ੍ਹ ਦੇ ਬੱਚਿਆਂ ਦਾ ਧਿਆਨ ਜਿਹੜਾ ਇਸ ਪਾਸੇ ਵੱਲ ਜ਼ਿਆਦਾ ਜਾ ਰਿਹਾ